ਸਤਿ ਸ਼੍ਰੀ ਅਕਾਲ ਮੈਮ ਜੀ ਮੈਮ ਬਿਜ਼ਨਸ ਐਨਾਲਾਇਸ ਕੀਤਾ ਸੀ ਅਤੇ ਅਕਾਊਂਟਸ ਸਹੀ ਤਰ੍ਹਾਂ ਮੈਨੇਜ ਨਹੀਂ ਹੁੰਦੇ ਪਏ ਜੀ ਇਹ ਪ੍ਰੋਬਲਮ ਕਿਉਂ ਆ ਰਹੀ ਆ ਤਾਂ ਉਹਦੀ ਪੇ ਵੀ ਦੇਣੀ ਪਊਗੀ ਉਹਦੀ ਪੇ ਵੀ ਦੇਣੀ ਪਊਗੀ ਤਾਂ ਉਹਦੇ ਨਾਲ ਮੈਨੂੰ ਪ੍ਰੋਬਲਮ ਆਏਗੀ ਕੋਈ ਹੋਰ ਤਰੀਕਾ ਨਹੀਂ ਹੈਗਾ ਕੋਈ ਹੋਰ ਸਲਿਊਸ਼ਨ ਦੱਸੋ ਜਿਹੜਾ ਘਪਲਾ ਕਰਦਾ ਉਹਨੂੰ ਲੱਭੋ ਤੁਸੀਂ ਅਸੀਂ ਉਹਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਵਾਂਗੇ

ਓਕੇ ਓਕੇ ਓਕੇ ਜੀ ਥੈਂਕਸ